ਅੱਜ ਕੱਲ੍ਹ ਸਭ ਤੋਂ ਵੱਧ ਵਰਤੀਆਂ ਜਾਣ ਵਾਲੀਆਂ ਐਪਾਂ ਜਿਵੇਂ ਵੱਟਸਐਪ ਇੰਸਟਾਗ੍ਰਾਮ ਫੇਸਬੁੱਕ ਅਤੇ ਆਪਣਾ ਗੂਗਲ ਪੇ ਵਗੈਰਾ ਇਹੋ ਜਿਹੀਆਂ ਬਹੁਤ ਐਪਾਂ ਨੇ ਜਿਹੜੀਆਂ ਅੱਜ ਕੱਲ੍ਹ ਬਹੁਤ ਜ਼ਿਆਦਾ ਵਰਤੀਆਂ ਜਾਂਦੀਆਂ ਨੇ ਅਤੇ ਜੇ ਮੈਂ ਇਹਨਾਂ ਦੇ ਫਾਇਦਿਆਂ ਦੀ ਗੱਲ ਕਰਾਂ ਤਾਂ ਸਮਾਰਟ ਫੋਨ ਦੇ ਬਹੁਤ ਫਾਇਦੇ ਨੇ ਜਿਵੇਂ ਦੂਰ ਕੋਈ ਬੈਠਾ ਹੈ ਤਾਂ ਉਹਦੇ ਨਾਲ ਗੱਲ ਕਰ ਸਕਦੇ ਹਾਂ ਆਪਾਂ ਅਤੇ ਫੇਸ ਕੋਲ ਕਰ ਸਕਦੇ ਹਾਂ ਅਤੇ ਕੋਈ ਵੀ ਚੀਜ਼ ਆਪਾਂ ਔਨਲਾਈਨ ਔਡਰ ਕਰ ਸਕਦੇ ਹਾਂ ਕਿਤੇ ਲੋਕੇਸ਼ਨ ਆਪਾਂ ਨੂੰ ਨਹੀਂ ਮਿਲ ਰਹੀ ਜਾਂ ਉਹਨੂੰ ਸਰਚ ਕਰ ਸਕਦੇ ਹਾਂ ਅਤੇ ਜੇ ਨੁਕਸਾਨ ਦੀ ਗੱਲ ਕਰੀਏ ਤਾਂ ਨੁਕਸਾਨ ਹੈ ਇਹਦੇ ਨੁਕਸਾਨ ਜਿਵੇਂ ਪੜ੍ਹਾਈ ਦਾ ਨੁਕਸਾਨ ਜ਼ਿਆਦਾਤਰ ਇਹਦੇ ਵਿੱਚ ਜ਼ਿਆਦਾ ਸਮਾਂ ਦੇਣ ਨਾਲ ਫੋਨ ਨੂੰ ਬਹੁਤ ਸਾਰੇ ਨੁਕਸਾਨ ਨੇ ਪੜ੍ਹਾਈ ਦਾ ਨੁਕਸਾਨ ਹੋ ਗਿਆ ਅਤੇ ਆਪਣੀਆਂ ਅੱਖਾਂ ਦਾ ਜਿਵੇਂ ਅੱਖਾਂ ਦੀ ਰੌਸ਼ਨੀ ਦਾ ਨੁਕਸਾਨ ਹੋ ਗਿਆ ਅਤੇ ਬਹੁਤ ਸਾਰੇ ਬੱਚੇ ਆਪਣਾ ਗੇਮ ਨਾਲ ਜ਼ਿਆਦਾ ਉਹ ਹੋ ਜਾਂਦੇ ਨੇ ਜਿਹੜਾ ਜਿਨ੍ਹਾਂ ਦਾ ਬਿਲਕੁਲ ਧਿਆਨ ਹੀ ਨਹੀਂ ਲੱਗਦਾ ਹੈ ਪੜ੍ਹਾਈ 'ਚ ਜਾਂ ਫੇਲ ਹੋਣ ਦੀ ਵਜ੍ਹਾ ਬਣ ਜਾਂਦੇ ਨੇ ਅਤੇ ਇਹੋ ਜਿਹੇ ਬਹੁਤ ਸਾਰੇ ਨੁਕਸਾਨ ਨੇ ਇਹਦੇ